ਹੈਲੋ ਹਾਂਜੀ ਤੁਸੀਂ ਫਲਿੱਪਕਾਰਡ ਤੋਂ ਬੋਲਦੇ ਪਏ ਹੋ ਮੈਂ ਨਾ ਇੱਕ ਬੜੇ ਚਿਰਾਂ ਤੋਂ ਦੇਖਦੀ ਪਈ ਸੀ ਕਿ ਮੈਨੂੰ ਇੱਕ ਨੀਡ ਸੀ ਡਿਨਰ ਸੈੱਟ ਦੀ ਅਤੇ ਮੈਂ ਬਾਜ਼ਾਰ ਦੇ ਵਿੱਚ ਕਈ ਸ਼ੋਪ 'ਤੇ ਦੇਖਿਆ ਡਿਜ਼ਾਇਨ ਵੀ ਮੈਨੂੰ ਪਸੰਦ ਆਏ ਬਟ ਉਹਨਾਂ ਦੀ ਕੋਸਟ ਜ਼ਿਆਦਾ ਹੋਣ ਕਰਕੇ ਤਾਂ ਮੈਂ ਮਤਲਬ ਅਫੋਡ ਨਹੀਂ ਸੀ ਕਰ ਸਕਦੀ ਸੋ ਮੈਂ ਬਾਅਦ ਵਿੱਚ ਇਸ ਤਰ੍ਹਾਂ ਹੀ ਫੋਨ 'ਤੇ ਲੱਗੀ ਸੀ ਅਤੇ ਤੁਹਾਡੀ ਮੈਂ ਐਡ ਦੇਖੀ ਅਤੇ ਉਹਦੇ ਵਿੱਚ ਦੇਖਿਆ ਕਿ ਸੇਲ ਲੱਗੀ ਹੋਈ ਹੈ ਸੋ ਮੈਂ ਉਹਨੂੰ ਔਡਰ ਕੀਤਾ ਅਤੇ ਉਹ ਮਤਲਬ ਕਿ ਔਡਰ ਤੋਂ ਬਾਅਦ ਜਦੋਂ ਮੇਰੇ ਘਰ ਪਹੁੰਚਿਆ ਡਿਨਰ ਸੈਟ ਤਾਂ ਬੜੀ ਅੱਛੀ ਉਹਦੀ ਪੈਕਿੰਗ ਸੀ ਬੜੀ ਵਧੀਆ ਤਰੀਕੇ ਨਾਲ ਉਹਨੂੰ ਪੈਕ ਕੀਤਾ ਸੀਗਾ ਅਤੇ ਮੈਨੂੰ ਦੇਖ ਕੇ ਬੜੀ ਖੁਸ਼ੀ ਹੋਈ ਮੈਂ ਕਿਹਾ ਚਲੋ ਦੇਖਦੇ ਹਾਂ ਵਰਤ ਕੇ ਇਹਨੂੰ ਮੇਰੇ ਫਰੈਂਡਸ ਵੀ ਆਏ ਹੋਏ ਸੀ ਮੇਰੇ ਕੋਲ ਹੀ ਸੀਗੇ ਔਰ ਘਰ ਦੇ ਵੀ ਸੀਗੇ ਅਤੇ ਕਿ ਔਡਰ ਜਿਹੜਾ ਆ ਉਹ ਆ ਗਿਆ ਅਤੇ ਅਸੀਂ ਬਹੁਤ ਖੁਸ਼ ਸੀਗੇ ਅਤੇ ਜਦੋਂ ਮੈਂ ਉਹਨੂੰ ਕੱਢ ਕੇ ਦੇਖਿਆ ਅਤੇ ਫਸਟ ਤਾਂ ਮੈਨੂੰ ਉਹਦਾ ਪ੍ਰਿੰਟ ਬਹੁਤ ਅੱਛਾ ਲੱਗਾ ਉਹਦਾ ਮਟੀਰੀਅਲ ਕਾਫੀ ਮੈਨੂੰ ਸੋਲਿਡ ਲੱਗਿਆ ਮੈਂ ਕਿਹਾ ਚਲੋ ਦੇਖਦੇ ਹਾਂ ਵਰਤ ਕੇ ਜਦੋਂ ਮੈਂ ਯੂਜ ਕੀਤਾ ਮਤਲਬ ਕਿ ਖਾਣਾ ਵਗੈਰਾ ਅਸੀਂ ਉਹਨਾਂ 'ਚ ਸਰਵ ਕੀਤਾ ਖਾਧਾ ਅਤੇ ਬੜਾ ਅੱਛਾ ਲੱਗਾ ਮੈਨੂੰ ਜਦੋਂ ਅਸੀਂ ਉਹਨਾਂ ਨੂੰ ਮਤਲਬ ਕਿ ਸਭ ਤੋਂ ਮੇਨ ਗੱਲ ਤਾਂ ਇਹ ਹੁੰਦੀ ਹੈ ਕਿ ਵੋਸ਼ ਕਰਨ ਦੇ ਵਿੱਚ ਉਹਦੇ ਦਾਗ ਵਗੈਰਾ ਨਾ ਉੱਥੇ ਲੱਗੇ ਰਹਿਣ ਜਾਂ ਮਤਲਬ ਕਿ ਅੱਛੀ ਤਰ੍ਹਾਂ ਕਲੀਨ ਹੋਵੇ ਜਾਂ ਤਾਂ ਮਟੀਰੀਅਲ ਕੁਛ ਆਵਾਜ਼ ਨਾ ਜ਼ਿਆਦਾ ਕਰਦਾ ਹੋਵੇ ਅਤੇ ਉਹ ਮੈਨੂੰ ਬਹੁਤ ਵਧੀਆ ਲੱਗਾ ਜਦਕਿ ਪਹਿਲਾਂ ਵੀ ਮੈਂ ਡਿਨਰ ਸੈਟ ਇੱਕ ਦੋ ਸਾਡੇ ਘਰ ਹੈਗੇ ਸੀ ਅਤੇ ਬੱਚੇ ਤੋੜ ਤਾੜ ਦਿੰਦੇ ਸੀ ਜਾਂ ਉਹਨਾਂ 'ਤੇ ਦਾਗ ਨਹੀਂ ਸੀ ਉੱਤਰਦਾ ਬਟ ਇਹ ਮੈਨੂੰ ਬਹੁਤ ਵਧੀਆ ਲੱਗਾ ਕੁਆਲਿਟੀ ਵੀ ਅੱਛੀ ਲੱਗੀ ਸੋ ਮੇਰੀਆਂ ਫਰੈਂਡਸ ਵੀ ਬਹੁਤ ਖੁਸ਼ ਸੀਗੀਆਂ ਕਿ ਇਹਦੀ ਡਿਜ਼ਾਇਨਿੰਗ ਵੀ ਬਹੁਤ ਵਧੀਆ ਹੈ ਸੋ ਮੈਨੂੰ ਇਹ ਬਹੁਤ ਵਧੀਆ ਲੱਗਾ ਔਰ ਮੈਂ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਕਿ ਤੁਸੀਂ ਬਹੁਤ ਅੱਛਾ ਜਿਹੜਾ ਮਟੀਰੀਅਲ ਆ ਉਹ ਬਣਾਇਆ ਔਰ ਮੇਰੇ ਬਜਟ ਵਿੱਚ ਸੀਗਾ ਇਹ ਕੋਈ ਖਾਸ ਮਹਿੰਗਾ ਨਹੀਂ ਸੀ ਸੋ ਥੈਂਕ ਯੂ ਸੋ ਮੱਚ